ਪੰਜਾਬ ਵਿੱਚ ਬਹੁਤ ਹੀ ਮਸ਼ਹੂਰ ਮਸ਼ਹੂਰ ਯੂਟਿਊਬ ਚੈਨਲ ਅਸ਼ਕੇ ਨਾਂ ਦਾ ਇੱਕ ਯੂਟਿਊਬ ਵੀਡੀਓ ਜਾਂ ਅੰਪਾਇਰ ਭੰਗੜਾ ਅੰਪਾਇਰ ਅਤੇ ਅਸੀਂ ਆਮ ਦੇਖਦੇ ਰਹਿੰਦੇ ਕਿਉਂਕਿ ਅਸੀਂ ਭੰਗੜੇ ਦੇ ਸ਼ੌਕੀਨਾਂ ਹਾਂ ਅਤੇ ਭੰਗੜਾ ਪਾਉਂਦੇ ਵੀ ਦੇਖਦੇ ਹਨ ਪੰਜਾਬੀ ਇੱਕ ਤਾਂ ਉੱਪਰੋਂ ਅਸੀਂ ਹੈਗੇ ਵੀ ਪੰਜਾਬੀ ਹਾਂ ਦੇ ਪੰਜਾਬੀ ਸੰਗੀਤਾਂ ਨਾਲ ਪਿਆਰ ਵੀ ਕਰਦੇ ਅਤੇ ਭੰਗੜਾ ਵੀ ਪੰਜਾਬੀ ਓ ਪੰਜਾਬ 'ਚ ਪੰਜਾਬ ਦੇ ਗੀਤਾਂ 'ਤੇ ਪਾਉਂਦੇ ਆ ਅਤੇ ਹਾਂਜੀ ਬਿਲਕੁਲ ਹੈਗੇ ਹਾਂ ਅਤੇ ਅਸ਼ਕੇ ਆ ਅਤੇ ਇੱਕ ਹੈਗਾ ਭੰਗੜਾ ਅੰਪਾਇਰ ਜੋ ਕਿ ਬਹੁਤ ਹੀ ਵਧੀਆ ਭੰਗੜਾ ਲੋਕ ਨਾਚ ਗਿੱਧਾ ਬੋਲੀਆਂ ਅਤੇ ਲੋਕ ਗੀਤ ਲੋਕ ਨਾਚ ਤਕਰੀਬਨ ਸਾਰਾ ਕੁਝ ਵਧੀਆ ਦਿਖਾਉਦੇ ਆ ਦਿਖਾਉਂਦੇ ਵੀ ਉਹਨਾਂ ਦੇ ਕਾਫੀ ਪੰਜਾਬ 'ਚ ਕੀ ਬਾਹਰੋਂ ਵੀ ਬਾਹਰੋਂ ਵੀ ਬਹੁਤ ਹੀ ਮਤਲਬ ਯੂਟਿਊਬ ਚੈਨਲ ਉਹਨਾਂ ਦਾ ਗਰੋਥ 'ਤੇ ਆ ਕਾਫੀ ਅਤੇ ਉਹਨਾਂ ਕੋਲ ਸਟੂਡੈਂਟ ਵੀ ਬਹੁਤ ਜ਼ਿਆਦਾ ਸਿੱਖਦੇ ਹਨ ਭੰਗੜਾ ਕਿਉਂਕਿ ਭੰਗੜੇ ਭੰਗੜੇ ਭੰਗੜਾ ਭੰਗੜਾ ਪਾਉਂਦੇ ਹੋਏ ਅੱਧੀ ਥਕਾਨ ਅਤੇ ਅੱਧੀ ਸਟਰੈਸ ਲੈਹ ਜਾਂਦੀ ਆ ਅਤੇ ਅਸੀਂ ਵੀ ਇਸੇ ਕਰਕੇ ਉਹਨਾਂ ਦਾ ਜ਼ਿਆਦਾਤਰ ਚੈਨਲ ਯੂਟਿਊਬ 'ਤੇ ਦੇਖ ਲੈਦੇ ਆ ਭੰਗੜਾ ਦੇਖਦੇ ਦੇਖਦੇ ਤਾਂ ਰੂਹ ਖੁਸ਼ ਹੋ ਜਾਂਦੀ ਆ ਦੂਜਾ ਜੋ ਮਨ ਜੇ ਕਿਤੇ ਸੈਡ ਸੂਡ ਹੁੰਦਾ ਉਦਾਂ ਹੀ ਨੱਚਦੇ ਟੱਪਦੇ ਦੇਖ ਕੇ ਵਧੀਆ ਹੋ ਜਾਂਦਾ